ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਰਾਮ ਲਾਲ ਬੋਲ ਰਿਹਾ ਜੀ ਹਾਂਜੀ ਸਰ ਜੀ ਸਰ ਜੀ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਹੋ ਸਰ ਮੈਂ ਸਿੱਕਮ ਤੋਂ ਕਰਦਾ ਸਰ

ਮੈਂ ਪਟਿਆ ਪਟਿਆਲੇ ਦੇ ਵਿੱਚ ਹਾਂ ਜੀ ਵੈਸੇ ਗੁਰੂ ਘਰ ਤਾਂ ਇੱਕ ਫਤਿਹਗੜ੍ਹ ਸਾਹਿਬ ਓ ਆਪਣਾ ਸੋਰੀ ਇੱਕ ਬਹਾਦਰਗੜ੍ਹ ਸਾਹਿਬ ਹੈ ਜੀ ਇਤਿਹਾਸਿਕ ਗੁਰਦੁਆਰਾ ਉਰੇ ਮੋਤੀ ਬਾਗ ਹੈ ਜੀ ਅਤੇ ਆਪਣਾ ਇੱਕ ਦੁੱਖ ਨਿਵਾਰਨ ਆ ਜੀ

ਇਹਨਾਂ ਦਾ ਇਤਿਹਾਸ ਇਹ ਹੈ ਸਰ ਕਿ ਇਹ ਸਿੱਖ ਧਰਮ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਜੀ ਅਤੇ ਸਿੱਖ ਧਰਮ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਹੈ ਜਿਹੜਾ ਆ ਆਪਣਾ ਬਹਾਦਰਗੜ੍ਹ ਸਾਹਿਬ ਗੁਰਦੁਆਰਾ ਹੈ ਜੀ ਇਹ ਬਹੁਤ ਹੀ ਪੁਰਾਤਨ ਅਤੇ ਇਤਿਹਾਸਿਕ ਗੁਰਦੁਆਰਾ ਮੰਨਿਆ ਗਿਆ ਹੈ ਸਰ ਇਤਿਹਾਸਿਕ

ਹਾਂਜੀ ਸਰ ਉਰੇ ਮੋਤੀ ਮੋਤੀ ਬਾਗ ਸਰ ਜਿਹੜਾ ਮੋਤੀ ਬਾਗ ਹੈ ਜੀ ਉਰੇ ਵੀ ਮਤਲਬ ਇਹ ਜੀ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਇਹਦੇ ਨਾਲ ਸਿੱਖ ਧਰਮ ਬਹੁਤ ਨਜ਼ਦੀਕੀ ਨਾਲ ਜੁੜਿਆ ਹੋਇਆ ਜੀ ਪਰ ਜਦੋਂ ਜਦੋਂ ਕੋਈ ਵੀ ਕੋਈ ਵੀ ਇ ਇਤਿਹਾਸ ਵਿੱਚ ਕੋਈ ਨਾਲ ਜੁੜੀ ਚੀਜ਼ ਹੁੰਦੀ ਹੈ ਸਿੱਖਾਂ ਦੇ ਬਾਰੇ ਤਾਂ ਉਰੇ ਲੋਕ ਬਹੁਤ ਵਧ ਮਾਤਰਾ 'ਚ ਦਰਸ਼ਨ ਲੈਣ ਆਉਂਦੇ ਨੇ ਜੀ ਅਤੇ ਇਸ ਇਸਦੇ ਵਿੱਚ ਅਰਦਾਸ ਹੁੰਦੀ ਹੈ ਸਵੇਰੇ ਅਤੇ ਸ਼ਾਮ ਅਰਦਾਸ ਹੁੰਦੀ ਹੈ ਲੋਕ ਨਹਾ ਧੋਹ ਕੇ ਆਉਂਦੇ ਨੇ ਜੀ ਅਤੇ ਅਰਦਾਸ ਸੁਣ ਕੇ ਬੜਾ ਸਕੂਨ ਮਹਿਸੂਸ ਕਰਦੇ ਨੇ ਉਹ ਉਹਨਾਂ ਉਹਨਾਂ ਨੂੰ ਮਤਲਬ ਇੰਨਾਂ ਸਕੂਨ ਮਹਿਸੂਸ ਹੁੰਦਾ ਕਿ ਉਹਨਾਂ ਜਿੰਦਗੀ 'ਚ ਕੋਈ ਕਸ਼ਟ ਨਹੀਂ ਉਹਨਾਂ ਨੂੰ ਲੱਗਦਾ ਅਤੇ ਸ਼ੁਰੂ ਤੋਂ ਹੀ ਮਤਲਬ ਜੁੜੇ ਹੋਏ ਹਾਂ ਅਸੀਂ ਵੀ ਜੁੜੇ ਹੋਏ ਨੇ ਇਹਦੇ ਨਾਲ ਹੀ ਜੀ ਅਤੇ ਹਾਂਜੀ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ ਹੋ ਗਿਆ ਜੀ ਸ਼ਹਿਰ ਦੇ ਨਾਲ ਹੀ ਹੈ ਹਾਂ ਮੋ ਮੋਤੀ ਬਾਗ ਸਾਹਿਬ ਗੁਰਦੁਆਰਾ ਸ਼ਹਿਰ ਦੇ ਨਾਲ ਹੀ ਹੈ ਸ਼ਹਿਰ ਤੋਂ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਕਰੀਬ ਕਿਲੋ ਦੋ ਕਿਲੋਮੀਟਰ ਬਾਹਰ ਆ

ਹਾਂਜੀ ਦੁੱਖ ਨਿਵਾਰਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਉਹਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਮਾਤਰਾ 'ਚ ਲੋਕ ਦਰਸ਼ਨ ਲੈਣ ਲਈ ਆਉਂਦੇ ਨੇ ਸਰ ਉਰੇ ਵੀ ਬਹੁਤ ਸਕੂਨ ਮਿਲਦਾ ਲੋਕਾਂ ਨੂੰ ਅਰਦਾਸ ਹੁੰਦੀ ਹੈ ਦੁਆਰ ਦੇ ਵਿੱਚ ਬੈਠਦੇ ਨੇ ਅਤੇ ਬਾਬਾ ਜੀ ਦਾ ਲੰਗਰ ਪਾਣੀ ਵੀ ਛਕਦੇ ਨੇ ਅਤੇ ਸਕੂਨ ਨਾਲ ਮਤਲਬ ਬਹੁਤ ਹੀ ਸਕੂਨ ਮਿਲਦਾ ਮੈਂ ਵੀ ਸਰ ਉੱਥੇ ਜਾਂਦਾ ਅਤੇ ਇਸ਼ਨਾਨ ਕਰਦੇ ਹਾਂ ਸਰੋਵਰ ਹੈ ਜੀ ਇਸ਼ਨਾਨ ਕਰਦੇ ਹਾਂ ਅਤੇ ਗੁਰੂ ਦੀ ਬਾਣੀ ਨੂੰ ਸੁਣਦੇ ਹਾਂ ਜੀ ਜਿਹਦੇ ਨਾਲ ਬਹੁਤ ਹੀ ਸਕੂਨ ਮਿਲਦਾ

ਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਗੁਰੂ ਗ੍ਰੰਥ ਸਾਹਿਬ ਉਰੇ ਵੀ ਬਿਰਾਜਮਾਨ ਨੇ ਅਤੇ ਉਰੇ ਸਵੇਰੇ ਮੋਰਨਿੰਗ ਟਾਈਮ ਕਰੀਬ ਸਾਢੇ ਤਿੰਨ ਪੌਣੇ ਚਾਰ ਵਜੇ ਹੀ ਮਤਲਬ ਕਿ ਸਾਰਾ ਸ਼ੁਰੂ ਹੋ ਜਾਂਦਾ ਅਰਦਾਸ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਸਵੇਰੇ ਤਿੰਨ ਚਾਰ ਵਜੇ ਜਾਣਾ ਸ਼ੁਰੂ ਕਰ ਦਿੰਦੇ ਨੇ ਜੀ ਅਤੇ ਹਾਂਜੀ ਅਤੇ ਉੱਥੇ ਬੈਠਦੇ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠਦੇ ਨੇ ਸਰ ਅਰਦਾਸ ਸੁਣਦੇ ਨੇ ਅਤੇ ਜਿਹਦੇ ਕਰਕੇ ਉਹਨਾਂ ਤਕਰੀਬਨ ਤਕਰੀਬਨ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ ਜੀ ਅਤੇ ਇਸ਼ਨਾਨ ਕਰਕੇ ਜਾਂਦੇ ਨੇ ਸਾਰੇ ਸ਼ਾਮ ਨੂੰ ਵੀ ਸ਼ਾਮ ਨੂੰ ਵੀ ਅਰਦਾਸ ਹੁੰਦੀ ਹੈ ਸਰ ਸ਼ਾਮੀ ਵੀ ਪਹੁੰਚਦੇ ਨੇ ਉੱਥੇ ਸਾਰੇ ਪੂਰਾ ਪਰਿਵਾਰ ਵੀ ਕਈ ਵਾਰੀ ਪਹੁੰਚਦਾ ਨਹੀਂ ਤਾਂ ਜ਼ਿਆਦਾਤਰ ਤਕਰੀਬਨ ਲੋਕ ਸਵੇਰੇ ਜਾਂ ਸ਼ਾਮ ਨੂੰ ਹੀ ਜਾਂਦੇ ਨੇ ਸਰ ਜਿਸ ਟਾਈਮ ਅਰਦਾਸ ਸੁਣੀ ਜਾਂਦੀ ਹੈ ਸਵੇਰੇ ਸ਼ਾਮ ਅਰਦਾਸ ਕਰੀ ਜਾਂਦੀ ਹੈ ਸਰ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡੀ ਮਹੱਤਤਾ ਹੈ ਜੀ ਔਰ ਆਹ ਸਿੱਖ ਧਰਮ ਹੀ ਮਤਲਬ ਉਸ ਨੂੰ ਮੰਨਦਾ ਸਿੱਖ ਧਰਮ ਤੋਂ ਇਲਾਵਾ ਹੋਰ ਵੀ ਧਰਮ ਬਹੁਤ ਜ਼ਿਆਦਾ ਹੈਗੇ ਜਿਹੜੇ ਇਸਨੂੰ ਮੰਨਦੇ ਹਨ ਕਿਉਂਕਿ ਇਹ ਇਕ ਐਸਾ ਐਸਾ ਗ੍ਰੰਥ ਹੈ ਜਿਹੜਾ ਇਹਦੀ ਰਚਨਾ ਜਿਹੜੀ ਕਲਯੁਗ ਦੇ ਵਿੱਚ ਹੋਈ ਹੈ ਸਰ ਅਤੇ ਇਸ ਤੋਂ ਲੋਕ ਬਹੁਤ ਪ੍ਰਭਾਵਿਤ ਨੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ

ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ